ਇਹੋ ਜਿਹੀਆਂ ਬਹੁਤ ਸਾਰੀਆਂ ਸਕੀਮਾਂ ਹਨ ਜਿਨ੍ਹਾਂ ਦਾ ਅਸੀਂ ਲਾਭ ਉਠਾ ਸਕਦੇ ਹਾਂ ਕੋਈ ਜਦ ਬੰਦਾ ਬਿਮਾਰ ਹੋਵੇ ਤਾਂ ਉਸ ਲਈ ਮੋਦੀ ਸਰਕਾਰ ਨੇ ਪੰਜ ਲੱਖ ਦਾ ਕਾਰਡ ਬਣਾਇਆ ਹੈ ਅਤੇ ਅਸੀਂ ਉਹ ਪੰਜ ਲੱਖ ਦੇ ਕਾਰਡ ਦੇ ਨਾਲ ਆਪਦੀ ਬਿਮਾਰੀ ਜੇ ਕੋਈ ਫੈਮਲੀ ਬੰਦਾ ਬਿਮਾਰ ਹੈ ਤਾਂ ਉਸਦੀ ਅਸੀਂ ਹੋਸਪੀਟਲ ਜਾ ਕੇ ਉਹ ਕਾਰਡ ਦਾ ਫਾਇਦਾ ਉਠਾ ਸਕਦੇ ਹਾਂ ਅਤੇ ਮੇਰੇ ਦਾਦਾ ਜੀ ਦੇ ਗੋਡੇ ਖਰਾਬ ਸੀ ਅਤੇ ਅਸੀਂ ਉਸ ਕਾਰਡ ਰਾਹੀਂ ਮੁਫ਼ਤ ਇਲਾਜ ਕਰਾਇਆ ਅਤੇ ਮੇਰੇ ਦਾਦਾ ਜੀ ਵਧੀਆ ਹੋਗੇ ਗਰੀਬ ਲੋਕਾਂ ਦੇ ਲਈ ਕਾਰਡ ਇਹ ਲਈ ਬਹੁਤ ਜ਼ਿਆਦਾ ਗਰੀਬ ਲੋਕਾਂ ਦਾ ਗਰੀਬ ਲੋਕ ਇਸ ਕਾਰਡ ਦਾ ਫਾਇਦਾ ਉਠਾ ਸਕਦੇ ਹਨ ਕਿਉਂਕਿ ਇਹ ਮੋਦੀ ਸਰਕਾਰ ਨੇ ਬਣਾਏ ਹੈ ਪੰਜ ਪੰਜ ਲੱਖ ਦੇ ਜਿਹਦੇ ਘਰ 'ਚ ਕੋਈ ਵੀ ਬੰਦਾ ਬਿਮਾਰ ਹੈ ਅਤੇ ਉਹ ਕਾਰਡ ਲਿਆ ਕੇ ਆਪਦਾ ਕਰ ਸਕਦਾ ਹੈ ਅਤੇ ਆਪਦੀ ਸਿਹਤ ਲਈ ਉਹ ਪੈਸਾ ਮਤਲਬ ਪੈਸੇ ਮੁਫ਼ਤ ਪੈਸੇ ਤੋਂ ਵੀ ਇਲਾਜ ਕਰਾ ਸਕਦੇ ਹੈ ਇਸ ਕਾਰਡ ਰਾਹੀਂ ਬਹੁਤ ਜੇ ਕਿਸੇ ਦੇ ਗੋਡੇ ਗੁਰਦੇ ਜਾਂ ਹੋਰ ਕੋਈ ਵੀ ਤਰ੍ਹਾਂ ਦੀ ਬਿਮਾਰੀ ਵਿੱਚ ਇਹ ਕਾਰਡ ਰਾਹੀਂ ਉਹ ਆਪਦਾ ਇਲਾਜ ਕਰਾ ਸਕਦੇ ਹਨ ਮੁਫ਼ਤ ਇਲਾਜ ਕਰਾ ਕੇ ਉਹ ਗਰੀਬ ਮੋਦੀ ਸਰਕਾਰ ਨੇ ਗਰੀਬ ਲੋਕਾਂ ਦੇ ਲਈ ਕਾਰਡ ਕਿ ਉਹ ਆਪਦੇ ਸਰਕਾਰ ਉਹ ਅਪਦਾ ਮੁਫ਼ਤ ਇਲਾਜ ਕਰਾ ਸਕਣ ਅਤੇ ਆਪਦਾ ਵਧੀਆ ਇਲਾਜ ਕਰਾ ਕੇ ਅਤੇ ਵਧੀਆ ਰਹਿਣ ਅਤੇ ਉਹ ਆਪਦੇ ਘਰ ਬਾਰ ਚਲਾ ਸਕਣ ਅਤੇ ਜਿਹੜਾ ਪੈਸਾ ਅਸੀਂ ਹੋਸਪੀਟਲਾਂ 'ਚ ਲਾਵਾਂਗੇ ਅਤੇ ਉਹ ਅਸੀਂ ਘਰ ਲਾ ਸਕਦੇ ਹਾਂ ਸਰਕਾਰ ਮੋਦੀ ਸਰਕਾਰ ਨੇ ਬਹੁਤ ਵਧੀਆ ਗਰੀਬ ਲੋਕਾਂ ਲਈ ਕਾਰਡ ਬਣਾਏ ਹੈ ਕਿ ਉਹ ਆਪਦੇ ਮੁਫ਼ਤ ਇਲਾਜ ਕਰਾ ਸਕਣ